ਡਰਾਇੰਗ ਦਾ ਮੈਨੂੰ ਜ਼ਿਆਦਾ ਸ਼ੌਕ ਤਾਂ ਹੈ ਨੀਗਾ ਪਰ ਬਚਪਨ ਵਿੱਚ ਜਦੋਂ ਆਪਾਂ ਕਲਾਸ ਦੇ ਵਿੱਚ ਟੀਚਰ ਡਰਾਇੰਗ ਦਾ ਪੀਰੀਅਡ ਹੁੰਦਾ ਸੀਗਾ ਕਹਿ ਦਿੰਦੇ ਸੀ ਕਿ ਡਰਾਇੰਗ ਬਣਾਉ ਉਸ ਵਿੱਚ ਮੈਨੂੰ ਯਾਦ ਆ ਆਪਣੀ ਇੱਕ ਬਹੁਤ ਹੀ ਸੋਹਣੀ ਛੋਟੀ ਜਿਹੀ ਗੱਲ ਕਿ ਇੱਕ ਵਾਰੀ ਸਾਨੂੰ ਸਾਡੇ ਟੀਚਰ ਨੇ ਕਿਹਾ ਸੀ ਕਿ ਜਿਹੜਾ ਵੀ ਤੁਹਾਡੇ ਮਨ ਦੀ ਚੀਜ਼ ਹੈ ਪਸੰਦ ਆ ਉਹ ਤੁਸੀਂ ਬਣਾਉ ਅਤੇ ਮੈਂ ਉਹਦੇ ਵਿੱਚ ਨਾ ਇੱਕ ਆਪਣਾ ਆਪਣਾ ਘਰ ਬਣਾਇਆ ਸੀ ਬਹੁਤ ਸੋਹਣਾ ਨਾਲ ਸੀਗੇ ਦਰਖਤ ਲਾਏ ਹੋਏ ਅਤੇ ਘਰ ਬਹੁਤ ਸੋਹਣਾ ਬਣਾਇਆ ਅਤੇ ਉਹ ਜਿਹੜਾ ਮੈਨੂੰ ਯਾਦ ਆ ਕਿ ਮੇਰੇ ਮੰਮੀ ਜੀ ਨੇ ਘਰੇ ਅਜੇ ਵੀ ਲਾਇਆ ਹੋਇਆ ਉਹਦੇ ਵਿੱਚ ਲਾ ਕੇ ਅਤੇ ਉਸ ਟਾਈਮ ਮੈਨੂੰ ਪਤਾ ਨਹੀਂ ਸੀ ਜਦੋਂ ਮੈਂ ਮੰਮੀ ਨੂੰ ਪੁੱਛਿਆ ਮੰਮੀ ਇਹ ਕਹਿੰਦੇ ਬੇਟਾ ਤੂੰ ਬਹੁਤ ਸੋਹਣੀ ਹੱਟ ਬਣਾਈ ਆ ਫਿਰ ਜਿਉਂ ਜਿਉਂ ਮੈਂ ਅਗਾਂਹ ਵੱਡਾ ਹੁੰਦਾ ਹੋ ਗਿਆ ਮੈਂ ਉਹ ਹੱਟ ਵੱਲ ਹੀ ਦੇਖ ਕੇ ਸੋਚਦਾ ਰਿਹਾ ਕਿ ਦੇਖੋ ਆਹ ਜਿਹੜੀ ਮੈਂ ਚੀਜ਼ ਬਣਾਈ ਆ ਇਹ ਘਰ ਆ ਘਰ ਬੰਦੇ ਦੇ ਰਹਿਣ ਵਾਸਤੇ ਬਣਾਉਣਾ ਪੈਂਦਾ ਕਿੰਨੀ ਮਿਹਨਤ ਨਾਲ ਇਹ ਹੱਟ ਛੋਟੀ ਜਿਹੀ ਹੱਟ ਤਾਂ ਆਪਾਂ ਬਣਾ ਲਈ ਚਲੋ ਪੈਨਸਲ ਨਾਲ ਬਣਾਤੀ ਪਰ ਘਰ ਬਣਾਉਣਾ ਬਹੁਤ ਹੀ ਔਖਾ ਹੈ ਉਸ ਲਈ ਸੰਘਰਸ਼ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਫਿਰ ਸਾਰਾ ਕੁਛ ਹੁੰਦਾ